ਹੈਲੋ ਤੁਸੀਂ ਸਵੀਗੀ ਤੋਂ ਬੋਲ ਰਹੇ ਹੋ ਮੇਰਾ ਨਾਮ ਮੀਨਾ ਹੈ ਮੈਂ ਇੱਕ ਔਡਰ ਦਿੱਤਾ ਸੀ ਜਿਹ ਜਿਹਦੇ ਵਿੱਚ ਕਿ ਮੈਂ ਦਾਲ ਪਨੀਰ ਮੰਗਵਾਇਆ ਸੀ ਔਰ ਉਹਦੇ ਨਾਲ ਚਾਵਲ ਮੰਗਵਾਏ ਸੀ ਪਰ ਮੈਂ ਆਪਣਾ ਔਡਰ ਚਾਰ ਵਜੇ ਪਲੇਸ ਕੀਤਾ ਸੀ ਹੁਣ ਅਤੇ ਪੰਜ ਦਸ ਹੋ ਚੁੱਕਿਆ ਮੇਰਾ ਔਡਰ ਹਜੇ ਤੱਕ ਨਹੀਂ ਆਇਆ ਮੈਂ ਮੇਰੇ ਔਡਰ ਦਾ ਨੰਬਰ ਦੋ ਚਾਰ ਪੰਜ ਛੇ ਹੈ ਮੈਂ ਹਮੇਸ਼ਾ ਤੁਹਾਡੇ ਤੋਂ ਔਡਰ ਮੰਗਵਾਉਂਦੀ ਹਾਂ ਪਹਿਲਾਂ ਤਾਂ ਇੱਦਾਂ ਕਦੀ ਹੋਇਆ ਨਹੀਂ ਇਸ ਵਾਰ ਕਿਉਂ ਇੱਦਾਂ ਹੋਇਆ ਸਾਡੇ ਘਰ ਗੈਸਟ ਆਏ ਹੋਏ ਨੇ ਅਤੇ ਉਹ ਬੈਠੇ ਹੋਏ ਨੇ ਮੈਂ ਉਹਨਾਂ ਨੂੰ ਸਰਵ ਕਰਨਾ ਦੱਸੋ ਕਿ ਮੇਰਾ ਔਡਰ ਕਿਉਂ ਨਹੀਂ ਆਇਆ ਹਜੇ ਤੱਕ ਹੁਣ ਤਾਂ ਪੰਜ ਦਸ ਵੀ ਹੋ ਚੁੱਕੇ ਹੈ ਅਤੇ ਹਜੇ ਤੱਕ ਵੀ ਔਡਰ ਨਹੀਂ ਆਇਆ ਮੈਂ ਆਪਣਾ ਜਾਂ ਤਾਂ ਮੈਨੂੰ ਡਿਲੀਵਰੀ ਬੋਆਏ ਦਾ ਨੰਬਰ ਸੈਂਡ ਕਰ ਦਿਓ ਕਿ ਤਾਂ ਜੋ ਮੈਂ ਉਹਦੇ ਨਾਲ ਕੰਟੈਕਟ ਕਰ ਪਾਵਾਂ ਮੈਨੂੰ ਤੁਹਾਡੇ ਐਪ 'ਤੇ ਡਿਲੀਵਰੀ ਬੋਆਏ ਦਾ ਨੰਬਰ ਸ਼ੋਅ ਨਹੀਂ ਹੋ ਰਿਹਾ ਕਿਰਪਾ ਕਰਕੇ ਮੈਨੂੰ ਉਹਦਾ ਨੰਬਰ ਸ਼ੋਅ ਕੀਤਾ ਜਾਵੇ ਕਿ ਤਾਂ ਜੋ ਮੈਂ ਉਹਦੇ ਨਾਲ ਸਿੱਧਾ ਕੋਂਟੈਕਟ ਕਰਾਂ ਕਿ ਮੇਰਾ ਔਡਰ ਹਜੇ ਤੱਕ ਕਿਉਂ ਨਹੀਂ ਆਇਆ ਧੰਨਵਾਦ